ਭਾਰਤ ਦੀ ਸਿੱਖਿਆ ਪ੍ਰਣਾਲੀ ਆਧੁਨਿਕ ਸਿੱਖਿਆ ਪ੍ਰਣਾਲੀ ਹੈ ਅਤੇ ਭਾਰਤ ਸਿੱਖਿਆ ਦੇ ਖੇਤਰ ਵਿੱਚ ਕਾਫ਼ੀ ਉੱਨਤੀ ਵੀ ਕਰ ਚੁੱਕਿਆ ਪਰ ਇੰਨੀ ਉੱਨਤੀ ਕਰਨ ਦੇ ਬਾਵਜੂਦ ਵੀ ਭਾਰਤ 'ਚ ਅਗਰ ਸ਼ਾਖਰਤਾ ਦਾ ਆਂਕਲਣ ਕੀਤਾ ਜਾਵੇ ਤਾਂ ਫਿਰ ਵੀ ਭਾਰਤ ਸਿੱਖਿਆ ਦੇ ਤੌਰ 'ਤੇ ਬੜਾ ਪਿਛੜਿਆ ਹੋਇਆ ਹੈ ਕਈ ਕਮੀਆਂ ਹਨ ਸਿੱਖਿਆ ਦੇ ਖੇਤਰ ਵਿੱਚ ਜਿਹੜੀਆਂ ਅਸੀਂ ਅੱਜ ਵੀ ਦੂਰ ਨਹੀਂ ਕਰ ਪਾਏ ਸਭ ਤੋਂ ਵੱਡੀ ਗੱਲ ਹੈ ਕਿ ਪ੍ਰਾਈਵੇਟ ਸਕੂਲਾਂ ਨੂੰ ਜ਼ਿਆਦਾ ਮਹੱਤਵ ਦਿੱਤਾ ਜਾਂਦਾ ਹੈ ਲੇਕਿਨ ਪ੍ਰਾਈਵੇਟ ਸਕੂਲਾਂ ਨੂੰ ਸਾਰੇ ਮਾਪੇ ਜਿਨ੍ਹਾਂ ਦਾ ਥੋੜ੍ਹਾ ਆਰਥਿਕ ਸਤਰ ਨੀਵਾਂ ਹੈ ਉਹ ਉਹਨਾਂ ਨੂੰ ਅਫੋਰਡ ਨਹੀਂ ਕਰ ਸਕਦੇ ਅਤੇ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ 'ਚ ਵੀ ਨਹੀਂ ਭੇਜ ਸਕਦੇ ਅਗਰ ਸਰਕਾਰੀ ਸਕੂਲਾਂ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਸਿੱਖਿਆ ਚੰਗੀ ਤਰ੍ਹਾਂ ਮੀਨਸ ਜਿਹੜੇ ਨਿਮਨ ਦਰਜੇ ਦੇ ਲੋਕ ਹਨ ਉਹ ਸਿੱਖਿਆ ਨੂੰ ਹਾਸਿਲ ਕਰ ਸਕਦੇ ਹਨ ਲੇਕਿਨ ਫਿਰ ਵੀ ਉਹਨਾਂ ਸਕੂਲਾਂ ਦੇ ਵਿੱਚ ਸਿੱਖਿਆ ਦੇ ਖੇਤਰ ਵਿੱਚ ਇੰਨਾ ਧਿਆਨ ਨਹੀਂ ਦਿੱਤਾ ਜਾਂਦਾ ਬੱਚਿਆਂ ਨੂੰ ਸਰਕਾਰ ਨੇ ਕਾਫ਼ੀ ਜ਼ਿਆਦਾ ਸੁਵਿਧਾਵਾਂ ਦਿੱਤੀਆਂ ਹਨ ਜਿਵੇਂ ਫ੍ਰੀ ਕਿਤਾਬਾਂ ਦਿੱਤੀਆਂ ਹਨ ਦਿੱਤੀਆਂ ਜਾਂਦੀਆਂ ਹਨ ਅਤੇ ਉਹਨਾਂ ਨੂੰ ਵਰਦੀਆਂ ਵੀ ਫ੍ਰੀ ਉਪਲੱਬਧ ਕਰਵਾਈਆਂ ਜਾਂਦੀਆਂ ਹਨ ਅਤੇ ਆਉਣ ਜਾਣ ਵਾਸਤੇ ਵੀ ਦਿੱਕਤ ਨਾ ਹੋਵੇ ਇਸ ਕਰਕੇ ਸਾਈਕਲ ਦਿੱਤੇ ਜਾਂਦੇ ਹਨ ਫਿਰ ਵੀ ਕਈ ਇਲਾਕੇ ਐਸੇ ਹਨ ਭਾਰਤ ਦੇ ਜੋ ਅੱਜ ਵੀ ਬਹੁਤ ਜ਼ਿਆਦਾ ਪਿਛੜੇ ਹੋਏ ਹਨ ਅਤੇ ਲੋਕਾਂ ਦਾ ਜਿਹੜਾ ਮਾਨਸਿਕ ਸਤਰ ਹੈ ਮਾਨਸਿਕ ਲੈਵਲ ਆ ਉਹ ਵੀ ਕਾਫ਼ੀ ਜ਼ਿਆਦਾ ਡਾਊਨ ਆ ਜ਼ਿਆਦਾਤਰ ਮਾਪੇ ਅੱਜ ਵੀ ਪਿੰਡ ਦੇ ਖੇਤਰਾਂ ਵਿੱਚ ਅਨਪੜ੍ਹ ਹੀ ਪਾਏ ਜਾਂਦੇ ਹਨ ਜਿਹੜੇ ਮੀਨਸ ਸਿੱਖਿਆ ਦੇ ਮਹੱਤਵ ਨੂੰ ਨਹੀਂ ਸਮਝਦੇ ਅਤੇ ਨਾ ਉਹ ਇਹ ਚਾਹੁੰਦੇ ਹਨ ਕਿ ਉਹਨਾਂ ਦਾ ਬੱਚਾ ਥੋੜ੍ਹਾ ਪੜ੍ਹ ਲਿਖ ਕੇ ਅੱਗੇ ਵਧੇ ਅਤੇ ਉਹ ਜ਼ਿਆਦਾਤਰ ਆਪਣੇ ਬੱਚਿਆਂ ਨੂੰ ਮਜ਼ਦੂਰੀਆਂ 'ਚ ਹੀ ਸ਼ਾਮਿਲ ਕਰ ਲੈਂਦੇ ਹਨ ਇਸ ਕਰਕੇ ਸਭ ਤੋਂ ਪਹਿਲਾ ਕੰਮ ਇਹ ਕਰਨਾ ਚਾਹੀਦਾ ਕਿ ਮਾਂ ਪਿਓ ਨੂੰ ਸਿੱਖਿਆ ਨੂੰ ਲੈ ਕੇ ਜਾਗਰੂਕ ਕਰਨਾ ਚਾਹੀਦਾ ਕਿ ਸਿੱਖਿਆ ਦਾ ਕਿੰਨਾ ਮਹੱਤਵ ਹੈ ਅਤੇ ਬੱਚਿਆਂ ਨੂੰ ਵੀ ਪਾਠਕ੍ਰਮ ਦੇ ਵਿੱਚ ਬੱਚਿਆਂ ਦੇ ਪਾਠਕ੍ਰਮ ਦੇ ਵਿੱਚ ਵਿਵਸਾਇਕ ਸਿੱਖਿਆ ਨੂੰ ਸ਼ਾਮਿਲ ਕਰਨਾ ਚਾਹੀਦਾ ਜ਼ਿਆਦਾਤਰ ਅੱਠਵੀਂ ਕਲਾਸ ਦੇ ਬੱਚਿਆਂ ਦੇ ਪਾਠਕ੍ਰਮ ਦੇ ਵਿੱਚ ਵਿਵਸਾਇਕ ਸਿੱਖਿਆ ਸ਼ਾਮਿਲ ਹੋਣੀ ਚਾਹੀਦੀ ਹੈ ਤਾਂ ਜੋ ਬੱਚੇ ਆਪਣੀ ਜ਼ਿੰਦਗੀ ਵਿੱਚ ਇਹ ਡਿਸਾਈਡ ਇਹ ਨਿਸ਼ਚਿਤ ਕਰ ਸਕਣ ਕਿ ਉਹਨਾਂ ਨੇ ਅੱਗੇ ਜਾ ਕੇ ਆਪਣਾ ਕਿਹੜਾ ਵਿਵਸਾਏ ਕਿਹੜਾ ਕਿੱਤਾ ਚੁਣਨਾ ਹੈ ਅਤੇ ਉਹਨਾਂ ਨੇ ਕੀ ਕਰਨਾ ਹੈ ਅਗਰ ਬੱਚਿਆਂ ਨੂੰ ਵਿਵਸਾਇਕ ਸਿੱਖਿਆ ਨਹੀਂ ਮਿਲਦੀ ਸਿੱਖਿਆ ਦੇ ਨਾਲ ਨਾਲ ਤਾਂ ਉਹ ਗਿਆਰਵੀਂ ਬਾਰਵੀਂ ਤੋਂ ਬਾਅਦ ਵੀ ਨਹੀਂ ਸੋਚ ਪਾਉਂਦੇ ਕਿ ਉਹਨਾਂ ਨੇ ਹੁਣ ਆਪਣੀ ਜ਼ਿੰਦਗੀ 'ਚ ਕਰਨਾ ਕੀ ਹੈ ਕਿਹੜਾ ਕੋਰਸ ਕਰਨਾ ਕਿਹੜਾ ਡਿਪਲੋਮਾ ਕਰਨਾ ਇਸ ਕਰਕੇ ਭਾਰਤ ਦੀ ਸਿੱਖਿਆ ਨੂੰ ਅਗਰ ਦੂਸਰੇ ਦੇਸ਼ਾਂ ਦੇ ਨਾਲ ਤੁਲਨਾ ਕੀਤੀ ਜਾਵੇ ਤਾਂ ਇਹੋ ਹੀ ਹੈ ਕਿ ਭਾਰਤ ਦੀ ਸਿੱਖਿਆ ਦੇ ਵਿੱਚ ਵਿਵਸਾਇਕ ਸਿੱਖਿਆ ਦੀ ਕਮੀ ਹੈ ਅਗਰ ਵਿਵਸਾਇਕ ਸਿੱਖਿਆ ਨੂੰ ਬਾਕੀ ਪਾਠਕ੍ਰਮ ਦੇ ਵਿੱਚ ਸ਼ਾਮਿਲ ਕੀਤਾ ਜਾਊਗਾ ਤਾਂ ਲੋਕ ਆਪਣੇ ਕਿੱਤੇ ਨੂੰ ਲੈ ਕੇ ਬੜੇ ਜਾਗਰੂਕ ਹੋਣਗੇ ਬੱਚਿਆਂ ਨੂੰ ਇੱਕ ਸਕੂਲ ਦੇ ਅੰਦਰੋਂ ਜੋ ਹੀ ਉਹਨਾਂ ਦੀ ਮਦਦ ਉਹਨਾਂ ਦੇ ਨ ਅਨਪੜ੍ਹ ਮਾਪੇ ਨਹੀਂ ਕਰ ਸਕਦੇ ਉਹਨਾਂ ਨੂੰ ਸਕੂਲ 'ਚ ਅਧਿਆਪਕ ਹੀ ਉਹਨਾਂ ਦੀ ਉਹ ਮਦਦ ਕਰਨਗੇ ਉਹ ਕਿੱਤ ਵਿਵਸਾਇਕ ਸਿੱਖਿਆ ਹੀ ਉਹਨਾਂ ਦੀ ਮਦਦ ਕਰੇਗੀ ਕਿ ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਕਿਹੜਾ ਚੰਗਾ ਵਿਵਸਾਏ ਚੰਗਾ ਪ੍ਰੋਫੈਸ਼ਨ ਚੁਣਨਾ ਹੈ ਇਸ ਕਰਕੇ ਆਪਣੀ ਸਿੱਖਿਆ ਨੂੰ ਜੋ ਸਿੱਖਿਆ ਪ੍ਰਣਾਲੀ ਹੈ ਭਾਰਤ ਦੀ ਉਹਨੂੰ ਆਧੁਨਿਕ ਤਦੇ ਬਣਾ ਸਕਦੇ ਹਾਂ ਜੇਕਰ ਅਸੀਂ ਉਹਦੇ ਵਿੱਚ ਵਿਵਸਾਇਕ ਸਿੱਖਿਆ ਨੂੰ ਲਾਗੂ ਕਰਾਂਗੇ ਪਾਠਕ੍ਰਮ ਦੇ ਬੋਝ ਨੂੰ ਵੀ ਘੱਟ ਕਰਨਾ ਬਹੁਤ ਜ਼ਰੂਰੀ ਹੈ ਕਿ ਉਹ ਭਾਰਤ ਦੀ ਸਿੱਖਿਆ ਦਾ ਜਿਹੜਾ ਪਾਠਕ੍ਰਮ ਹੈ ਅਲੱਗ ਅਲੱਗ ਲੈਵਲ ਹੋਣ ਦੇ ਬਾਵਜੂਦ ਜਿਵੇਂ ਸੀ ਬੀ ਐੱਸ ਈ ਆ ਗਿਆ ਆਈ ਸੀ ਐੱਸ ਈ ਆ ਗਿਆ ਅਤੇ ਪੰਜਾਬ ਬੋਰਡ ਬਹੁਤ ਵੱਖਰਾ ਰਹਿ ਜਾਂਦਾ ਹੈ ਅਤੇ ਉਹਦੇ ਵਿੱਚ ਜਿਹੜਾ ਪਾਠਕ੍ਰਮ ਦਾ ਬੋਝ ਹੈ ਉਹ ਬੱਚਿਆਂ ਦੇ ਦਿਮਾਗ ਨੂੰ ਬਿਲਕੁਲ ਹੀ ਉਹਨੇ ਨੈਰੋ ਸੰਕੁਚਿਤ ਕਰ ਦਿੱਤਾ ਹੋਇਆ ਹੈ ਅਤੇ ਬੱਚੇ ਬਹੁਤ ਪ੍ਰੇਸ਼ਾਨ ਰਹਿੰਦੇ ਹਨ ਇਸ ਕਰਕੇ ਸਰਕਾਰ ਨੂੰ ਕਈ ਐਸੀਆਂ ਨੀਤੀਆਂ ਬਣਾਉਣੀਆਂ ਚਾਹੀਦੀਆਂ ਜਿਹਦੇ ਨਾਲ ਸਰਕਾਰ ਪਾਠਕ੍ਰਮ ਨੂੰ ਨਿਸ਼ਚਿਤ ਕਰਦੇ ਅਤੇ ਬੱਚਿਆਂ ਦੇ ਸਿਰ ਤੋਂ ਥੋੜ੍ਹਾ ਬੋਝ ਹਟਾਵੇ ਅਤੇ ਜਿਹੜਾ ਇਗਜਾਮੀਨੇਸ਼ਨ ਪੈਟਰਨ ਆ ਜਿਹੜਾ ਪੇਪਰ ਨੂੰ ਲੈਣ ਦਾ ਸਿਸਟਮ ਆ ਉਹਦੇ ਵਿੱਚ ਉਹ ਚੇਂਜ ਕਰੇ